ਭੰਗੜੇ ਦੇ ਮਸ਼ਹੂਰ ਗੀਤ ਹਨ ਦੱਬਦੇ ਨਹੀਂ ਐਮੀ ਵਿਰਕ ਵੱਲੋਂ ਗਾਇਆ ਗਿਆ ਹੈ ਦੂਜਾ ਹੈ ਮੋਰਨੀ ਬਣ ਕੇ ਗੁਰੂ ਰੰਧਾਵਾ ਅਤੇ ਨੇਹਾ ਵੱਲੋਂ ਗਾਇਆ ਗਿਆ ਹੈ ਤੀਜਾ ਗਾਣਾ ਹੈ ਗੋਟ ਦਲਜੀਤ ਦੋਸਾਂਝ ਵੱਲੋਂ ਗਾਇਆ ਗਿਆ ਹੈ ਚੌਥਾ ਗਾਣਾ ਹੈ ਤੀਜੇ ਵੀਕ ਜੋ ਕਿ ਜੋਰਡਨ ਸੰਧੂ ਵੱਲੋਂ ਗਾਇਆ ਗਿਆ ਹੈ ਪੰਜਵਾਂ ਗਾਣਾ ਹੈ ਸਭ ਫੜੇ ਜਾਣਗੇ ਪਰਮਿਸ਼ ਵੱਲੋਂ ਗਾਇਆ ਗਿਆ ਹੈ ਛੇਵਾਂ ਗਾਣਾ ਹੈ ਬਿੱਲੋ ਜੋ ਕਿ ਗਿੱਪੀ ਗਰੇਵਾਲ ਵੱਲੋਂ ਗਾਇਆ ਗਿਆ ਹੈ ਸੱਤਵਾਂ ਗਾਣਾ ਹੈ ਮੁੱਛ ਜੋ ਕਿ ਦਲਜੀਤ ਦੋਸਾਂਝ ਵੱਲੋਂ ਗਾਇਆ ਗਿਆ ਹੈ ਅੱਠਵਾਂ ਗਾਣਾ ਹੈ ਓ ਹੋ ਹੋ ਸ ਸੁਖਬੀਰ ਇੱਕਾ ਵੱਲੋਂ ਗਾਇਆ ਗਿਆ ਹੈ ਨੌਵਾਂ ਗਾਣਾ ਹੈ ਤਿੰਨ ਪੈੱਗ ਜੋ ਕਿ ਸ਼ੈਰੀ ਮਾਨ ਵੱਲੋਂ ਗਾਇਆ ਗਿਆ ਹੈ ਦਸਵਾਂ ਗਾਣਾ ਹੈ ਡਾਇਮੰਡ ਜੋ ਕਿ ਗੁਰਨਾਮ ਭੁੱਲਰ ਵੱਲੋਂ ਗਾਇਆ ਗਿਆ ਹੈ ਗਿਆਰ੍ਹਵਾਂ ਗਾਣਾ ਹੈ ਤੂੰ ਹੀ ਦੱਸ ਦੇ ਜੋ ਕਿ ਸਿਮਰ ਪਨੱਗ ਵੱਲੋਂ ਗਾਇਆ ਗਿਆ ਹੈ ਜ ਬਾਰ੍ਹਵਾਂ ਗਾਣਾ ਹੈ ਸਾਡੀ ਗਲੀ ਜੋ ਕਿ ਹੁਸਨਪੁਰੀਆ ਨੇ ਗਾਇਆ ਗਿਆ ਹੈ ਅਤੇ ਤੀਜਾ ਗਾਣਾ ਹੈ ਹੈਵੀ ਵੇਟ ਭੰਗੜਾ ਜੋ ਕਿ ਰਣਜੀਤ ਬਾਵੇ ਵੱਲੋਂ ਗਾਇਆ ਗਿਆ ਹੈ ਚੋ ਚੌਦ੍ਹਵਾਂ ਗਾਣਾ ਹੈ ਵੰਗ ਦਾ ਨਾਪ ਜੋ ਕਿ ਐਮੀ ਵਿਰਕ ਵੱਲੋਂ ਗਾਇਆ ਗਿਆ ਹੈ ਪੰਜਵਾਂ ਗਾਣਾ ਹੈ ਲੈਬਰਗੀਨੀ ਉੱਤੇ ਮਾਰੇ ਗੇੜੀਆਂ ਜੋ ਕਿ ਦਲਜੀਤ ਦੋਸਾਂਝ ਵੱਲੋਂ ਗਾਇਆ ਗਿਆ ਹੈ ਮੇਰਾ ਸਭ ਤੋਂ ਮਨਪਸੰਦ ਗਾਣਾ ਹੈ ਹੈ ਹੈਵੀ ਵੇਟ ਭੰਗੜਾ ਭੰਗੜਾ ਪਊਗਾ ਹੈਵੀ ਵੇਟ ਬੱਲੀਏ ਹੱਥ ਮਾਰ ਕੇ ਪੱਟਾਂ 'ਤੇ ਜੋ ਕਿ ਰਣਜੀਤ ਬਾਵੇ ਵੱਲੋਂ ਗਾਇਆ ਗਿਆ ਹੈ ਸੋਲ੍ਹਵਾਂ ਗਾਣਾ ਹੈ ਤਾਰੇ ਬੱਲੀਏ ਜੋ ਕਿ ਐਮੀ ਵਿਰਕ ਵੱਲੋਂ ਗਾਇਆ ਗਿਆ ਹੈ ਸਤ ਸਤਾਰ੍ਹਵਾਂ ਗਾਣਾ ਹੈ ਇਨਫੋ ਜੋ ਕਿ ਜੋਰਡਨ ਸੰਧੂ ਵੱਲੋਂ ਗਾਇਆ ਗਿਆ ਹੈ ਅਠਾਰ੍ਹਵਾਂ ਗਾਣਾ ਹੈ ਬਲੈਕ ਲੇਬਲ ਜੋ ਕਿ ਬਨੀ ਗਿੱਲ ਵੱਲੋਂ ਗਾਇਆ ਗਿਆ ਹੈ ਉੱਨ੍ਹੀਵਾਂ ਗਾਣਾ ਹੈ ਸੁਰਮਾ ਜੋ ਕਿ ਦਲਜੇ ਦਲਜੀਤ ਦੁਸਾਂਝ ਵੱਲੋਂ ਗਾਇਆ ਗਿਆ ਹੈ ਵੀਹਵਾਂ ਗਾਣਾ ਹੈ ਕਮਲੀ ਜੋ ਕਿ ਅਮ ਮਨਕੀਰਤ ਔਲਖ ਵੱਲੋਂ ਗਾਇਆ ਗਿਆ ਹੈ ਇਹ ਬਹੁਤ ਸੋਹਣਾ ਗਾਣਾ ਹੈ ਇਹ ਵੀ ਮੈਨੂੰ ਬਹੁਤ ਪਸੰਦ ਹੈ ਇੱਕੀਵਾਂ ਗਾਣਾ ਹੈ ਦਾਰੂ ਬਦਨਾਮ ਜੋ ਕਿ ਬਹੁਤ ਚੰਗਾ ਗਾਣਾ ਹੈ ਪਰਮ ਸਿੰਘ ਅਤੇ ਕਮਲ ਕਾਲ ਵੱਲੋਂ ਗਾਇਆ ਗਿਆ ਹੈ ਦਾਰੂ ਬਦਨਾਮ ਕਰਤੀ ਅਤੇ ਬਾਰ੍ਹਵਾਂ ਗਾਣਾ ਹੈ ਪਲਾਜੋ ਕੁਲਵਿੰਦਰ ਬਿੱਲਾ ਜੋ ਕਿ ਕੁੜੀਆਂ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇਈਵਾਂ ਗਾਣਾ ਹੈਗਾ ਪੰਜ ਤਾਰਾ ਵੀ ਇਹ ਵੀ ਬਹੁਤ ਸੋਹਣਾ ਗਾਣਾ ਹੈ ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰਿਆਂ ਨੇ ਤੇਰਾ ਸਾਰਾ ਗੁੱਸਾ ਅਤੇ ਚੌਵੀਵਾਂ ਗਾਣਾ ਹੈਗਾ ਨਾਗ ਜ ਜੋ ਕਿ ਜੈਜੀ ਬੀ ਵੱਲੋਂ ਗਾਇਆ ਗਿਆ ਹੈ ਪੱਚੀਵਾਂ ਗਾਣਾ ਹੈ ਹੱਸ ਕੇ ਕੱਟ ਲਾ ਕਰਮਜੀਤ ਅਨਮੋਲ ਛੱਬੀਵਾਂ ਗਾਣਾ ਹੈ ਮੈਂ ਮੈਂ ਅਤੇ ਮੇਰੀ ਜਾਨ ਜੋ ਕਿ ਸ ਸਤਿੰਦਰ ਸਰਤਾਜ ਉਸਤਾਦ ਜੀ ਨੇ ਗਾਇਆ ਗੁਆ ਹੈ ਸਤਾਈਵਾਂ ਗਾਣਾ ਹੈ ਨੰਬਰ ਪੰਜ ਇੰਟੈਂਸ ਰਾਜ ਰਾਜ ਰਣਜੋਤ ਵੱਲੋਂ ਗਾਇਆ ਗਿਆ ਹੈਗਾ ਅਤੇ ਅਠਾਈਵਾਂ ਗਾਣਾ ਹੈ ਗੁਰਹੇ ਨਾਲ ਇਸ਼ਕ ਜੋ ਕਿ ਮਲਕੀਤ ਸਿੰਘ ਵੱਲੋਂ ਗਾਇਆ ਗਿਆ ਹੈਗਾ ਉਨੱਤੀਵਾਂ ਗਾਣਾ ਹੈ ਇੰਨਾ ਚਾਹੁੰਦੀ ਹਾਂ ਜੋ ਕਿ ਜੱਸੀ ਗਿੱਲ ਵੱਲੋਂ ਗਾਇਆ ਗਿਆ ਹੈ ਤੀਹਵਾਂ ਗਾਣਾ ਹੈ ਜੋ ਕਿ ਜੱਟ ਦੀ ਪਸੰਦ ਜੋ ਕਿ ਸ਼ਿਵ ਜੋਤ ਵੱਲੋਂ ਗਾਇਆ ਗਿਆ ਹੈ ਮੇਰੇ ਇਹਨਾਂ ਵਿੱਚੋਂ ਮਨਪਸੰਦ ਹੈਗੇ ਆ ਭੰਗੜਾ ਪਊਗਾ ਹੈਵੀ ਵੇਟ ਲੈਂਬਰਗੀਨੀ ਅਤੇ ਦੂਜਾ ਹੈਗਾ ਤੀਜਾ ਕਮਲੀ ਅਤੇ ਚੌਥਾ ਹੈਗਾ ਦਾਰੂ ਬਦਨਾਮ ਕਰਤੀ